ਪੰਜਾਬ ਵਿੱਚ ਸਿੱਖਿਆ ਪ੍ਰਣਾਲੀ ਤਾਂ ਬਹੁਤ ਹੀ ਜ਼ਿਆਦਾ ਵਧੀਆ ਜਿਵੇਂ ਕਿ ਸਕੂਲ ਦੇ ਵਿੱਚ ਬਹੁਤ ਸਾਰੇ ਇੱਦਾਂ ਦੇ ਕੋਰਸ ਹਨ ਪ੍ਰ ਪ੍ਰੋਗਰਾਮ ਹਨ ਜੋ ਸਾਨੂੰ ਪੜ੍ਹਾਏ ਜਾਂਦੇ ਪ੍ਰਾਈਮਰੀ ਨੂੰ ਅਲੱਗ ਸੈਕੰਡਰੀ ਨੂੰ ਅਲੱਗ ਪੜ੍ਹਾਏ ਜਾਂਦੇ ਹਨ ਜਿਵੇਂ ਕਿ ਪ੍ਰਾਈਮਰੀ ਦੀ ਬੱਚਿਆਂ ਦੇ ਅਕੋਡਿੰਗ ਉਨੇ ਹੀ ਕੋਜ਼ ਦਿੱਤੇ ਜਾਂਦੇ ਹਨ ਕਿ ਜਿੰਨੇ ਕਿ ਬੱਚੇ ਕਰ ਸਕਦੇ ਹਨ ਸਭ ਤੋਂ ਪਹਿਲੇ ਕਿ ਅਗਰ ਤਾਂ ਆਪਾਂ ਐਕਸਟਰਾ ਵਿਸ਼ਿਆਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਹੁੰਦਾ ਡਰੋਇੰਗ ਡਰੋਇੰਗ ਕੀ ਹੈ ਬਹੁਤ ਹੀ ਜ਼ਿਆਦਾ ਹਾਂ ਵਧੀਆ ਹੁੰਦੀ ਹੈ ਕਿ ਬੱਚੇ ਨੂੰ ਕਿਸ ਕੁਛ ਵੀ ਚੀਜ਼ ਨੂੰ ਡਰੋਅ ਕਰਨਾ ਅਗਰ ਤਾਂ ਕਿਸੇ ਦੇ ਵਿੱਚ ਉਹਨਾਂ ਨੂੰ ਦਿਲਚਸਪੀ ਹੈਗੀ ਹੈ ਹੈ ਉਹ ਸਿਖਾਇਆ ਦਿੱਤਾ ਜਾਂਦਾ ਉਹ ਬੱਚਿਆਂ ਨੂੰ ਵੀ ਸਿਖਾਇਆ ਦਿੱਤਾ ਜਾਂਦਾ ਹੈ ਅਤੇ ਅ ਅਲੱਗ ਐਕਟੀਵਿਟੀ ਜਿਵੇਂ ਕਿ ਖੇਡ ਵਗੈਰਾ ਵੀ ਸਿਖਾਈਆਂ ਜਾਂਦੀਆਂ ਹਨ ਅਤੇ ਬਹੁਤ ਸਾਰੀ ਇੱਦਾਂ ਦੀਆਂ ਚੀਜ਼ਾਂ ਹੈਗੀਆਂ ਜੋ ਕਿ ਉਹਨਾਂ ਨੂੰ ਸਿਖਾਈ ਜਾਂਦੀ ਸੰਕੈਡਰੀ ਪੱਧਰ 'ਤੇ ਬਹੁਤ ਸਾਰੇ ਇੱਦਾਂ ਦੇ ਕੋਂ ਪੀਟੀਸ਼ਨ ਵਗੈਰਾ ਕੀਤੇ ਜਾਂਦੇ ਹਨ ਜਿਵੇਂ ਕੀ ਅਹਾ ਇੰਗਲਿਸ਼ ਲਿਟਰੇਚਰ ਜਿਵੇਂ ਅ ਇੰਗਲਿਸ਼ ਦੇ ਵਿੱਚ ਟੋਕ ਵਗੈਰਾ ਕਰਨੀ ਹੈ ਇੱਦਾਂ ਦੇ ਕਈ ਤਰ੍ਹਾਂ ਦੇ ਖੇਡ ਖੇਡੀਆਂ ਜਾਂਦੀਆਂ ਹਨ ਜੋ ਕਿ ਸੰਕੈਡਰੀ ਪੱਧਰ 'ਤੇ ਹੁੰਦੀਆਂ ਹਨ ਕਿਉਂਕਿ ਉਹ ਦੇਖਦੇ ਹਨ ਕਿ ਬੱਚਾ ਜੋ ਸਾਡੇ ਵੱਡੀ ਜਮਾਤ ਵਿੱਚ ਪੜ੍ਹਦਾ ਹੈ ਉਹ ਕਿੰਨੇ ਕੁ ਉਹਨਾਂ ਦਾ ਲੈਵਲ ਹਾਈ ਹੈਗਾ ਉਹ ਸਭ ਇਹ ਚੀਜ਼ਾਂ ਖੇਡੀਆਂ ਜਾਂਦੀਆਂ ਹਨ ਅਤੇ ਬਹੁਤ ਸਾਰੇ ਇੱਦਾਂ ਦੇ ਪਾਠਕ੍ਰਮ ਹੈਗੇ ਹਨ ਅ ਜੋ ਜਿਵੇਂ ਕਿ ਸਾਨੂੰ ਪੰਜਾਬ ਵਿੱਚ ਰਹਿੰਦੇ ਪੰਜਾਬੀ ਸਿਖਾਈ ਜਾਂਦੀ ਹੈ ਹਿੰਦੀ ਸਿਖਾਈ ਜਾਂਦੀ ਹੈ ਅੰਗਰੇਜ਼ੀ ਸਿਖਾਈ ਜਾਂਦੀ ਹੈ ਸੋਸ਼ਲ ਸਾਇੰਸ ਸਿਖਾਈ ਜਾਂਦੀ ਐ ਬਹੁਤ ਸਾਰੇ ਇਦਾਂ ਦੇ ਪਾਠਕ੍ਰਮ ਜੋ ਸਿਖਾਏ ਜਾਂਦੇ ਕਿਉਂਕਿ ਸਾਨੂੰ ਉਹ ਇਹ ਸਿਖਾਏ ਜਾਂਦੇ ਹਨ ਤਾਂ ਹੀ ਅਸੀਂ ਆਪਣੇ ਆਲੇ ਦੁਆਲੇ ਜਿਵੇਂ ਈ ਵੀ ਐੱਸ ਹੈ ਆਪਾਂ ਆਪਣੇ ਆਲੇ ਦੁਆਲੇ ਦੇ ਬਾਰੇ ਪੂਰੀ ਜਾਣਕਾਰੀ ਰੱਖ ਸਕਦੇ ਹਾਂ ਪੇੜ ਪੌਦਿਆਂ ਦੇ ਬਾਰੇ ਸਾਡੇ ਅਗਰ ਆਪਾਂ ਦੇਖਿਆ ਜਾਵੇ ਕਿ ਸਨਰੇਜ਼ ਦਾ ਸਾਨੂੰ ਕੀ ਕੀ ਇਫੈਕਟ ਹੈ ਉਹ ਸਭ ਚੀਜ਼ਾਂ ਈ ਵੀ ਐੱਸ ਦੇ ਵਿੱਚ ਆ ਜਾਂਦੀਆਂ ਹਨ ਅਤੇ ਇੱਦਾਂ ਦੇ ਬਹੁਤ ਇੱਦਾਂ ਦੇ ਪਾਠਕ੍ਰਮ ਹੈਗੇ ਹਨ ਜੋ ਸਾਨੂੰ ਬਹੁਤ ਜ਼ਿਆਦਾ ਹਰ ਸੀਖ ਦਿੰਦੇ ਆ